ਪੰਜਾਬੀ ਲੋਕ ਆਪਣੀਆਂ ਸੱਭਿਆਚਾਰ ਪਰੰਪਰਾਵਾਂ ਨੂੰ ਮਨਾਉਣ ਅਤੇ ਸਨਮਾਨ ਦੇਣ ਲਈ ਪਿਓਰ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਹਨ ਸਭ ਤੋਂ ਪਹਿਲਾਂ ਤਾਂ ਜੇ ਕੋਈ ਲੀਡਰ ਹੁੰਦਾ ਜਿਵੇਂ ਇਕੱਠ ਜਾਂ ਰੈਲੀ ਦੇ ਵਿੱਚ ਸਾਰਿਆਂ ਨੂੰ ਮਿਲਣ ਦੀ ਬਜਾਏ ਮਿਲਣ ਦੀ ਬਜਾਏ ਸਟੇਜ ਤੋਂ ਖੜ੍ਹ ਕੇ ਸਾਰਿਆਂ ਨੂੰ ਹੱਥ ਜੋੜ ਕੇ ਫਤਿਹ ਪ੍ਰਵਾਨ ਕਰਵਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਉੱਦਾਂ ਹੀ ਆਪਣੇ ਆਪਣੇ ਤੋਂ ਵੱਡੇ ਉਮਰ ਦੇ ਸਤਿਕਾਰਯੋਗ ਬਜ਼ੁਰਗ ਵੱਡੇ ਜਾਂ ਉਹਨਾਂ ਦੇ ਜਦੋਂ ਵੀ ਮਿਲਦੇ ਹਨ ਤਾਂ ਉਹਨਾਂ ਦੇ ਪੈਰੀਂ ਹੱਥ ਲਗਾ ਕੇ ਉਹ ਸਾਨੂੰ ਗਲੇ ਲਗਾਉਂਦੇ ਆ ਅਤੇ ਪਿਆਰ ਦੇਣ ਨਾਲ ਕਹਿੰਦੇ ਹਨ ਜਿਉਂਦਾ ਰਹਿ ਪੁੱਤ ਲੰਬੀਆਂ ਉਮਰਾਂ ਮਾਣ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਜਿਵੇਂ ਹੁਣ ਕੋਈ ਵੀ ਫੈਸਟੀਵਲ ਜਾਂ ਤਿਓਹਾਰ ਆਉਂਦਾ ਹੈ ਤਾਂ ਉਦੇ ਲੋਕ ਉੱਦਾਂ ਹੀ ਕਹਿ ਦਿੰਦੇ ਹਨ ਪਰ ਪੰਜਾਬੀ ਭਾਸ਼ਾ 'ਚ ਹਰੇਕ ਜਿਵੇਂ ਸੰਗਰਾਂਦ ਦਾ ਦਿਹਾੜਾ ਤਾਂ ਸ਼ੁਭ ਸੰਗਰਾਂਦ ਤ ਸ਼ੁੱਭ ਸੰਗਰਾਂਦ ਤ ਦੇ ਨਾਲ ਕਹਿ ਕੇ ਸੰਬੋਧਨ ਕਰਦੇ ਨੇ ਇੱਕ ਦੂਜੇ ਨੂੰ ਐਂਡ